ਆਪਣੇ ਕਿਰਦਾਰਾਂ ਦਾ ਵਿਕਾਸ ਕਰਨ ਲਈ ਮੈਂ ਨਵੇਂ ਨਵੇਂ ਲੋਕਾਂ ਨਾਲ ਗੱਲ ਬਾਤ ਕਰਦਾ ਰਹਿੰਦਾ ਹਾਂ ਅਤੇ ਕੋਸ਼ਿਸ਼ ਕਰਦਾ ਹਾਂ ਕਿ ਉਹਨਾਂ ਵੱਲੋਂ ਉਨ੍ਹਾਂ ਵਿੱਚ ਕੀ ਕੀ ਖਾਸ ਚੀਜ਼ਾਂ ਹਨ ਜੋ ਮੈਂ ਆਪਣੇ ਵਿੱਚ ਤਬਦੀਲੀ ਕਰਕੇ ਆਪਣੇ ਆਪ ਨੂੰ ਹੋਰ ਵਧੀਆ ਬਣਾ ਸਕਦਾ ਹਾਂ ਅਤੇ ਉਹਨਾਂ ਦੇ ਕਿਰਦਾਰ ਆਪਣੇ ਵਿੱਚ ਲਿਆ ਸਕਦਾ ਹਾਂ ਵੱਖ ਵੱਖ ਸਥਾਨਾਂ ਤੋਂ ਮੇਰੇ ਦੋਸਤ ਜਿਵੇਂ ਕਿ ਕੋਈ ਹਿਮਾਚਲ ਪ੍ਰਦੇਸ਼ ਤੋ ਕੋਈ ਜੰਮੂ ਤੋਂ ਜੋ ਵੀ ਮੈਨੂੰ ਮਿਲਦੇ ਹਨ ਤਾਂ ਮੈਂ ਉਹਨਾਂ ਤੋਂ ਨਵੇਂ ਉਨ੍ਹਾਂ ਦੇ ਨਵੇਂ ਨਵੇਂ ਸ਼ਬਦ ਅਤੇ ਉਹਨਾਂ ਦਾ ਕਲਚਰ ਜਾਣਨ ਦੀ ਕੋਸ਼ਿਸ਼ ਕਰਦਾ ਹਾਂ